ਪੰਜਾਬ ਵਿੱਚ ਬਹੁਤ ਹੀ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲੇਜ ਹੀ ਹਨ ਜਿਹਦੇ ਨਾਲ ਕਿ ਬੱਚੇ ਬਹੁਤ ਜ਼ਿਆਦਾ ਵਧੀਆ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਵੇਂ ਕਿ ਪ੍ਰਸਿੱਧ ਬਹੁਤ ਜ਼ਿਆਦਾ ਯੂਨੀਵਰਸਿਟੀਆਂ ਜਿੱਦਾਂ ਪੰਜਾਬ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਹੀ ਜਾ ਕੇ ਬੱਚੇ ਵਧੀਆ ਤੋਂ ਵਧੀਆ ਨੌਕਰੀਆਂ ਪ੍ਰਾਪਤ ਕਰਦੇ ਹਨ ਦੇਖੋ ਜੀ ਜੇ ਯੂਨੀਵਰਸਿਟੀਆਂ ਨਾ ਹੋਣ ਤਾਂ ਫਿਰ ਬੱਚੇ ਕਿੱਥੋਂ ਅਤੇ ਵਧੀਆ ਸਿੱਖਿਆ ਪ੍ਰਾਪਤ ਕਰਨਗੇ ਸਿੱਖਿਆ ਪ੍ਰਾਪਤ ਨਹੀਂ ਕਰਨਗੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਨੌਕਰੀਆਂ ਨਹੀਂ ਮਿਲਣਗੀਆਂ ਤਾਂ ਉਹ ਬੇਰੁਜ਼ਗਾਰ ਹੋ ਜਾਣਗੇ ਦੇਖੋ ਇਹ ਯੂਨੀਵਰਸਿਟੀਆਂ ਦੇ ਕਿੰਨੇ ਫਾਇਦੇ ਆ ਅਤੇ ਕਿੰਨਾ ਉਹ ਸਾਨੂੰ ਸਿੱਖਿਆ ਪ੍ਰਦਾਨ ਕਰਦੇ ਹੈ ਇਹਨਾਂ ਦੇ ਵਿੱਚ ਕਿੰਨੇ ਕੁ ਜ਼ਿਆਦਾ ਹੈ ਜਿੱਦਾਂ ਬੀ ਏ ਕਰਨੀ ਹੈ ਕਿਸੇ ਨੇ ਐੱਮ ਏ ਕਰਨੀ ਹੈ ਐੱਮ ਕੋਮ ਕਰਨੀ ਹੈ ਬੀ ਟੈਕ ਕਰਨੀ ਹੈ ਬੀ ਬੀ ਏ ਕਰਨੀ ਹੈ ਬੀ ਸੀ ਏ ਕਰਨੀ ਹੈ ਕਿ ਬਹੁਤ ਜ਼ਿਆਦਾ ਪ੍ਰੋਗਰਾਮਿੰਗ ਹੈਗੀ ਆ ਇਹਦੇ ਵਿੱਚ ਜਿਹਦੇ ਜਿਹੜੇ ਕਿ ਅਸੀਂ ਯੂਨੀਵਰਸਿਟੀ ਵਿੱਚ ਜਾ ਕੇ ਹੀ ਉਹਨਾਂ ਨੂੰ ਕਰ ਸਕਦੇ ਜੀ ਯੂਨੀਵਰਸਿਟੀ ਵਿੱਚ ਜਾਣਾ ਜਾਈਏ ਤਾਂ ਸਾਨੂੰ ਉਹ ਵਿੱਦਿਆ ਹਾਸਲ ਨਹੀਂ ਹੋ ਸਕਦੀ ਜੋ ਕਿ ਅਸੀਂ ਕਰਨਾ ਚਾਹੁੰਦੇ ਹਾਂ ਇੱਕ ਵਧੀਆ ਮਨੁੱਖ ਜਿਹੜਾ ਹੈ ਉਹ ਯੂਨੀਵਰਸਿਟੀ ਵਿੱਚ ਜਾ ਕੇ ਹੀ ਸਹੀ ਸਿੱਖਿਆ ਪ੍ਰਾਪਤ ਕਰ ਸਕਦਾ ਆਮ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਉਹ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ ਜੋ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਪ੍ਰਾਪਤ ਕਰ ਸਕਦੇ ਸੋ ਸਾਨੂੰ ਯੂਨੀਵਰਸਿਟੀ ਵਿੱਚ ਜਾ ਕੇ ਹੀ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਕਿਸੇ ਲੈਵਲ 'ਤੇ ਪਹੁੰਚ ਸਕੀਏ ਜਾਂ ਅਸੀਂ ਆਪਣੀ ਵਧੀਆ ਨੌਕਰੀ ਪ੍ਰਾਪਤ ਕਰ ਸਕੀਏ ਤਾਂ ਕਿ ਆਪ ਅਸੀਂ ਆਪਣਾ ਸ ਭਵਿੱਖ ਉਜਵੱਲ ਕਰ ਸਕੀਏ ਇਹਨਾਂ ਯੂਨੀਵਰਸਿਟੀਆਂ ਤੋਂ ਵਗੈਰ ਸਾਡਾ ਕੁਛ ਵੀ ਪਰ ਭਵਿੱਖ ਨਹੀਂ ਹੈ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਹੀ ਅਸੀਂ ਵਧੀਆ ਤੋਂ ਵਧੀਆ ਤਕਨੀਕ ਪ੍ਰਾਪਤ ਕਰ ਸਕਦੇ ਹਾਂ ਜਿੱਦਾਂ ਮਾਸਟਰੀ ਕਰਨੀ ਹੈ ਪੋਸਟ ਗਰੈਜੂਏਟ ਕਰਨੀ ਹੈ ਇਹ ਇਹਨਾਂ ਦੇ ਵਿੱਚ ਜਾ ਕੇ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ ਜੇ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਨਹੀਂ ਜਾ ਸਕਦੇ ਤਾਂ ਸਾਡਾ ਭਵਿੱਖ ਬਹੁਤਾ ਉਜਵੱਲ ਨਹੀਂ ਹੈ ਇਹਨਾਂ ਪ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਹੀ ਅਸੀਂ ਵਧੀਆ ਤੋਂ ਵਧੀਆ ਪ੍ਰ ਨੌਕਰੀ ਪ੍ਰਾਪਤ ਕਰ ਸਕਦੇ ਹਾਂ